ਦਿਵਾਲੀ ਇਹ ਤਿਉਹਾਰ ਰੌਸ਼ਨੀ ਜਿੱਤ ਅਤੇ ਖੁਸ਼ਹਾਲੀ ਦਾ ਪ੍ਰਤੀਕ ਹੈ ਲੋਕ ਇਸ ਦਿਨ ਆਪਣੇ ਘਰਾਂ ਨੂੰ ਰੌਸ਼ਨ ਕਰਦੇ ਹਨ ਅਤੇ ਪਰਿਵਾਰ ਅਤੇ ਦੋਸਤਾਂ ਨਾਲ ਇਕੱਠੇ ਹੁੰਦੇ ਹਨ ਹੋਲੀ ਇਹ ਤਿਉਹਾਰ ਰੰਗਾਂ ਪਿਆਰ ਅਤੇ ਖੁਸ਼ੀ ਦਾ ਪ੍ਰਤੀਕ ਹੈ ਲੋਕ ਇਸ ਦਿਨ ਰੰਗਾਂ ਨਾਲ ਇੱਕ ਦੂਸਰੇ ਉੱਤੇ ਰੰਗ ਲਗਾਉਂਦੇ ਹਨ ਅਤੇ ਨਾਚ ਗਾਉਂਦੇ ਹਨ ਉਗਾਦੀ ਇਹ ਤਿਉਹਾਰ ਨਵੇਂ ਸਾਲ ਦੀ ਸ਼ੁਰੂਆਤ ਦਾ ਪ੍ਰਤੀਕ ਹੈ ਲੋਕ ਇਸ ਦਿਨ ਆਪਣੇ ਪਰਿਵਾਰ ਅਤੇ ਦੋਸਤਾਂ ਨਾਲ ਇਕੱਠੇ ਹੁੰਦੇ ਹਨ ਅਤੇ ਨਵੇਂ ਸਾਲ ਲਈ ਸ਼ੁਭਕਾਮਨਾਵਾਂ ਕਰਦੇ ਹਨ ਸ਼ਕਰਾਂਤੀ ਇਹ ਤਿਉਹਾਰ ਫ਼ਸਲ ਦੇ ਨਾਲ ਮੇਲ ਕਰਦਾ ਹੈ